ਅੱਜ ਕੱਲ੍ਹ ਦੀ ਬੋਜਲ ਉਬਾਓ ਥਕਾਨ ਭਰੀ ਜ਼ਿੰਦਗੀ ਬਦ ਹਵਾ ਜ਼ਿੰਦਗੀ ਵਿੱਚ ਰਸ ਘੋਲਣ ਵਾਲੇ ਚੁਟਕੁਲੇ ਹਸਾ ਹਸਾ ਕੇ ਪੇਟ ਦਰਦ ਕਰ ਦਿੰਦੇ ਹਨ ਅਤੇ ਕਾਫੀ ਸਾਰੇ ਚੁਟਕਲੇ ਪੜ੍ਹ ਕੇ ਮਨ ਸ਼ਾਂਤ ਹੁੰਦਾ ਹੈ ਹੱਸ ਹੱਸ ਕੇ ਖੂਨ ਵਧਦਾ ਹੈ ਜ਼ਿੰਦਗੀ ਦਾ ਸਮਾਂ ਵਧੀਆ ਬਤੀਤ ਹੋ ਜਾਂਦਾ ਹੈ ਜੋ ਕਿ ਤੁਹਾਨੂੰ ਮੈਂ ਬਿਆਨ ਨਹੀਂ ਕਰ ਸਕਦੀ ਪਰ ਜਿਹੜੀ ਮੈਂ ਤੁਹਾਨੂੰ ਕਿਤਾਬ ਪੜ੍ਹੀ ਕਿਤਾਬ ਦੇ ਵਿੱਚ ਚੁਟਕਲਾ ਪੜ੍ਹਿਆ ਸੀ ਉਹ ਤੁਹਾਨੂੰ ਇੱਕ ਦੱਸਣ ਜਾ ਰਹੀ ਹਾਂ ਇੱਕ ਨਵੀਂ ਨਵੀਂ ਵਿਆਹੀ ਨੂੰ ਜਿਹੜੀ ਕਿ ਆਪਣੀ ਸੱਸ ਨੂੰ ਪੁੱਛਦੀ ਹੈ ਕਿ ਮਾਤਾ ਜੀ ਖਿਚੜੀ ਕਿਸ ਤਰ੍ਹਾਂ ਬਣਾਉਣੀ ਹੈ ਮਾਤਾ ਜੀ ਕਹਿੰਦੇ ਹਨ ਇੱਕ ਕਟੋਰੀ ਦਾਲ ਅੱਧੀ ਕਟੋਰੀ ਚਾਵਲ ਇਕ ਚਮਚ ਨਮਕ ਅੱਧਾ ਚਮਚ ਹਲਦੀ ਚਾਰ ਗਲਾਸ ਪਾਣੀ ਦੇ ਪਾ ਕੇ ਅਤੇ ਗੈਸ 'ਤੇ ਰੱਖ ਦੇ ਨੂੰਹ ਬੜੀ ਭੋਲੀ ਭਾਲੀ ਸੀ ਜਾਂ ਬਹੁਤ ਸਿਆਣੀ ਸੀ ਉਸ ਨੇ ਇਸ ਤਰ੍ਹਾਂ ਹੀ ਕੀਤਾ ਇੱਕ ਕਟੋਰੀ ਦਾਲ ਲਿੱਤੀ ਕਟੋਰੀ ਸਮੇਤ ਹੀ ਸਾਰਾ ਕੁਛ ਆਪਣਾ 'ਤੇ ਰੱਖ ਤਾ ਕੂਕਰ ਦੇ ਵਿੱਚ ਸਭ ਕੁਛ ਰੱਖ ਦਿੱਤਾ ਘੰਟੇ ਕੁ ਬਾਅਦ ਮਾਤਾ ਜੀ ਕਹਿੰਦੇ ਨੇ ਨੂੰਹ ਨੂੰ ਕਿ ਭੁੱਖ ਲੱਗੀ ਹੈ ਖਿਚੜੀ ਲਿਆ ਦੇ ਜਦੋਂ ਮਾ ਉਹ ਉੱਠੀ ਨਹੀਂ ਖਿਚੜੀ ਲਿਆਉਣ ਵਾਸਤੇ ਮਾਤਾ ਜੀ ਖੁਦ ਉਠ ਕੇ ਗਏ ਉਹਨਾਂ ਨੇ ਕੀ ਦੇਖਿਆ ਕਿ ਕੁੱਕਰ ਤਾਂ ਗੈਸ 'ਤੇ ਪਿਆ ਹੋਇਆ ਸੀ ਪਰ ਗੈਸ ਥੱਲਿਓਂ ਬੰਦ ਸੀ ਜਦੋਂ ਢੱਕਣ ਖੋਲ੍ਹਿਆ ਤਾਂ ਉਹਦੇ ਵਿੱਚ ਇੱਕ ਕਟੋਰੀ ਦਾਲ ਦੀ ਨਿਕਲ ਆਈ ਇੱਕ ਕਟੋਰੀ ਅੱਧੀ ਕਟੋਰੀ ਚਵਾਲ ਦੀ ਨਿਕਲ ਆਈ ਜਿਹੜੇ ਕਿ ਉਸਨੇ ਸ ਕੁਛ ਕਟੋਰੀਆਂ ਦੇ ਵਿੱਚ ਪਾ ਕੇ ਰੱਖਿਆ ਸੀ ਦੋ ਚਮਚ ਨਿਕਲੇ ਚਾਰ ਗਲਾਸ ਨਿਕਲੇ ਇਹ ਅੱਜ ਕੱਲ੍ਹ ਸਿਆਣੀ ਨੂੰਹ ਦਾ ਕੰਮ ਸੀ ਅਤੇ ਮਾਤਾ ਜੀ ਹੱਸ ਹੱਸ ਕੇ ਦੂਰੇ ਹੋ ਗਏ